ਜੇਕਰ ਗੱਲ ਕੀਤੀ ਜਾਏ ਗੇਮਿੰਗ ਕਮਿਊਨਿਟੀਆਂ ਦੀ ਮੇਰੀਆਂ ਗੇਮਿੰਗ ਕਮਿਊਨਿਟੀ ਵਿੱਚ ਗਿਆਰਾਂ ਤਰ੍ਹਾਂ ਦੀਆਂ ਟੀਮਾਂ ਹਨ ਅਤੇ ਗਿਆਰਾਂ ਟੀਮਾਂ ਵਿੱਚ ਗਿਆਰਾਂ ਗਿਆਰਾਂ ਬੰਦੇ ਹੀ ਪਾਏ ਜਾਂਦੇ ਹਨ ਜਿਹੜੀਆਂ ਕਿ ਆਪਾਂ ਕ੍ਰਿਕਟ ਦੀ ਗੇਮਿੰਗ ਕਮਿਊਨਿਟੀ ਹੈ ਜੋ ਕਿ ਆਪਾਂ ਸ਼ਨੀਵਾਰ ਅਤੇ ਐਤਵਾਰ ਨੂੰ ਖੇਡਣਾ ਬਹੁਤ ਹੀ ਜ਼ਿਆਦਾ ਪ੍ਰੈਫਰ ਕਰਦੇ ਹਾਂ ਅਤੇ ਛੇ ਵਜੇ ਗਰਾਊਂਡ ਵਿੱਚ ਪਹੁੰਚ ਜਾਂਦੇ ਹਾਂ ਅਤੇ ਛੇ ਵਜੇ ਤੋਂ ਲੈ ਕੇ ਬਾਰਾਂ ਵਜੇ ਤੱਕ ਸਾਡਾ ਇੱਕ ਇੱਕ ਮੈਚ ਹੁੰਦਾ ਹੈ ਅੰਮ੍ਰਿਤਸਰ ਵਿੱਚ ਇੱਕ ਗਰਾਊਂਡ ਬੁੱਕ ਕਰਵਾ ਕੇ ਅਸੀਂ ਉੱਥੇ ਤਿੰਨ ਜਾਂ ਚਾਰ ਪਿੱਚਾਂ ਲੱਗਾ ਕੇ ਹਰ ਤਰ੍ਹਾਂ ਦੀ ਗੇਮ ਖੇਡ ਸਕਦੇ ਹਾਂ ਪਰ ਆਪਾਂ ਕ੍ਰਿਕਟ ਨੂੰ ਖੇਡਣਾ ਹੀ ਪ੍ਰੈਫਰ ਕਰਦੇ ਹਾਂ ਕ੍ਰਿਕਟ ਦੇ ਨਿਯਮਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਗਿਆਰਾਂ ਗਿਆਰਾਂ ਬੰਦੇ ਦੋਨਾਂ ਟੀਮਾਂ ਵੱਲ ਹੁੰਦੇ ਹਨ ਬੋਲਿੰਗ ਟੀਮ ਦੇ ਦਸ ਬੰਦੇ ਫੀਲਡਿੰਗ ਕਰਦੇ ਹਨ ਅਤੇ ਇੱਕ ਬੰਦਾ ਬੋਲਿੰਗ ਕਰਦਾ ਹੈ ਅਤੇ ਬੈਟਿੰਗ ਟੀਮ ਦਾ ਦੋ ਬੰਦੇ ਬੈਟਿੰਗ ਕਰਦੇ ਹਨ ਜੋ ਕਿ ਇੱਕ ਦੂਸਰੇ ਨੂੰ ਆਹਮਣੇ ਸਾਹਮਣੇ ਖੜੇ ਹੁੰਦੇ ਹਨ ਅਤੇ ਬੋਲ ਨੂੰ ਮਾਰ ਕੇ ਇੱਕ ਦੂਜੇ ਵੱਲ ਭੱਜਦੇ ਹਨ ਇੱਕ ਅੱਧਾ ਰਨ ਲੈਣ 'ਤੇ ਅ ਜੋ ਗਰੀਸ ਆ ਉਹ ਚੇ ਉਹ ਚੇਂਜ ਹੋ ਜਾਂਦੀ ਹੈ ਅਤੇ ਦੂਸਰੇ ਬੰਦੇ ਦੀ ਬੈਟਿੰਗ ਆ ਜਾਂਦੀ ਹੈ ਗੇਮਿੰਗ ਕਮਿਊਨਿਟੀਆਂ ਦੀ ਅਗਰ ਹੋਰ ਵੀ ਗੱਲ ਕੀਤੀ ਜਾਏ ਮੈਂ ਦੋ ਤਿੰਨ ਤਿੱਗੇ ਗੇਮਿੰਗ ਕਮਿਊਟੀਆਂ ਨੂੰ ਹੋਰ ਵੀ ਪ੍ਰੈਫਰ ਕਰਦਾ ਹਾਂ ਅਤੇ ਗੇਮਾਂ ਨੂੰ ਪ੍ਰੈਫਰ ਕਰਦਾ ਹਾਂ ਜੋ ਕਿ ਇਸ ਤੋਂ ਇਲਾਵਾ ਬੋਲੀਵਾਲ ਹੈ ਅਤੇ ਬੈਡਮਿੰਟਨ ਹੈ ਬੈਡਮਿੰਟਨ ਦੇ ਵਿੱਚ ਵੀ ਮੈਂ ਤਿੰਨ ਚਾਰ ਕਮਿਊਨਟਾਂ ਦਾ ਹਿੱਸਾ ਹਾਂ ਜੋ ਕਿ ਅਸੀਂ ਸ਼ਨੀਵਾਰ ਜਾਂ ਐਤਵਾਰ ਕ੍ਰਿਕਟ ਮੈਚ ਨਾ ਹੋਣ 'ਤੇ ਅਸੀਂ ਉਹ ਖੇਡਣ ਲਈ ਚਲੇ ਜਾਈਦਾ ਹੈ ਉਹ ਖੇਡਣ ਦਾ ਵੀ ਵੱਖਰਾ ਹੀ ਮਜ਼ਾ ਹੈ ਜਿਹਦੇ ਵਿੱਚ ਇੱਕ ਨੈੱਟ ਹੁੰਦਾ ਹੈ ਛੋਟਾ ਜਿਹਾ ਅਤੇ ਦੂਸ ਦੋਨੋਂ ਤਰਫ ਦੋ ਦੋ ਬੰਦੇ ਖੇਡਦੇ ਹਨ ਅਤੇ ਚਿੜੀ ਨੂੰ ਆਪਣੇ ਛਿੱਕੇ ਦੇ ਨਾਲ ਮਾਰਨਾ ਅਤੇ ਥੱਲੇ ਡਿੱਗਣ ਤੋਂ ਬਚਾਉਣਾ ਖੇ ਇਸ ਨੂੰ ਚਿੜੀ ਛਿੱਕਾ ਕਿਹਾ ਜਾਂਦਾ ਹੈ